ਇਹ ਪੋਲਿਸੀ ਨੌਜਵਾਨਾਂ ਨੂੰ ਸੱਟੇਬਾਜੀ ਅਤੇ ਧੋਖਾਧੜੀ ਤੋਂ ਬਚਾਉਂਦੀ ਹੈ ਸਰਕਾਰ ਦੀ ਪੋਲਿਸੀ ਗੇਮਿੰਗ ਉਹਨਾਂ ਨੌਜਵਾਨਾਂ ਲਈ ਬਹੁਤ ਲਾਭਦਾਇਕ ਹੈ ਜਿਹੜੀ ਕੋਈ ਵੀ ਖੇਡ ਖੇਡਣ ਵਿੱਚ ਰੁਚੀ ਰੱਖਦੇ ਹਨ ਕਿਉਂਕਿ ਜਿੰਨ੍ਹਾਂ ਨੌਜਵਾਨਾਂ ਦੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨੀ ਹੁੰਦੀ ਹੈ ਉਹਨਾਂ ਨੂੰ ਸਰਕਾਰ ਪ੍ਰੋਤਸਾਹਨ ਵੱਜੋਂ ਸਰਟੀਫਿਕੇਟ ਦਿੰਦੀ ਹੈ ਜਿਸ ਨਾਲ ਉਹਨਾਂ ਨੂੰ ਅੱਗੇ ਬਹੁਤ ਲਾਭ ਹੁੰਦਾ ਹੈ ਉਹਨਾਂ ਲਈ ਵਿਸ਼ੇਸ਼ ਕੋਟਾ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਇਸ ਸਰਟੀਫਿਕੇਟ ਦੇ ਆਧਾਰ 'ਤੇ ਉਹਨਾਂ ਨੂੰ ਕਿਸੇ ਵੀ ਨੌਕਰੀ ਵਿੱਚ ਛੋਟ ਅਤੇ ਪਹਿਲ ਦਿੱਤੀ ਜਾਂਦੀ ਹੈ ਜਿਸ ਨਾਲ ਉਹ ਨੌਜਵਾਨ ਆਪਣਾ ਭਵਿੱਖ ਸੁਧਾਰ ਸਕਦੇ ਹਨ ਇਸ ਤਰ੍ਹਾਂ ਉਹਨਾਂ ਨੌਜਵਾਨਾਂ ਤੋਂ ਪ੍ਰਭਾਵਿਤ ਹੋ ਕੇ ਦੂਜੇ ਨੌਜਵਾਨ ਵੀ ਇਸ ਪੋਲਿਸੀ ਦਾ ਹਿੱਸਾ ਬਣਨ ਦੇ ਚਾਹਵਾਨ ਹੁੰਦੇ ਹਨ